ਗਤਕਾ ਸਿਖਲਾਈ ਪ੍ਰਣਾਲੀ ਵਿੱਚ ਗੱਤਕਾ ਦੀਆਂ ਕੁ ਕੁਕਾਨਾਂ ਤੇਜ਼ ਹਲ ਹਲਚਲਾਂ ਅਤੇ ਸ਼ਕਤੀਸ਼ਾਲੀ ਹਮਲੇ ਨਾਲ ਜੁੜੀ ਹੋਈ ਕਲਾ ਹੈ ਜਿਸ ਨੂੰ ਸਰੀਰ ਵਿੱਚ ਲੋੜੀਂਦਾ ਆਰਾਮ ਨਾ ਮਿਲੇ ਤਾਂ ਮਾਸਪੇਸ਼ੀਆਂ ਦੇ ਦਰਦ ਸੰਤੀਆਂ ਦਾ ਕੜਾ ਕਪਨ ਅਤੇ ਥਕਾਵਟ ਹੋ ਸਕਦੀ ਹੈ ਜੇਕਰ ਖਿਡਾਰੀ ਆਪਣੇ ਸਰੀਰ ਨੂੰ ਆਰਾਮ ਨਹੀਂ ਦਿੰਦੇ ਤਾਂ ਚੋਟਾਂ ਦੇ ਚਾਂਸ ਵੱਧ ਜਾਂਦੇ ਆ ਸਹੀ ਤਰੀਕੇ ਨਾਲ ਰਿਕਵਰੀ ਨਾ ਹੋਣ ਕਾਰਨ ਪ੍ਰਣਾਲੀਆਂ ਜੋ ਪੁਰਾਣੀਆਂ ਚੋਟਾਂ ਵੱਧ ਸਕਦੀਆਂ ਹਨ ਜਦੋਂ ਸਰੀਰ ਨੂੰ ਲੋੜੀਂਦਾ ਵਿਸਰਾਮ ਮਿਲਦਾ ਹੈ ਤਾਂ ਮਾਂਸ਼ਪੇਸ਼ੀਆਂ ਮੁੜ ਤਿਆਰ ਹੁੰਦੀਆਂ ਹਨ ਤੇ ਅਤੇ ਸ਼ਕਤੀ ਅਤੇ ਸਹਿਣਸ਼ੀਲਤਾ ਵੱਧਦੀ ਹੈ ਆਰਾਮ ਨਾਲ ਮਿਲਣ ਗਨ ਸਿਰ ਦਰਦ ਮਾਨਸਿਕ ਤਣਾਅ ਅਤੇ ਕੇਂਦਰਿਤ ਹੋਣ ਦੀ ਸਮੱਸਿਆ ਆ ਜ ਸਕਦੀ ਹੈ ਜੋ ਕਿ ਗੱਤਕਾ ਦੀ ਸਿਖਲਾਈ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਗ ਹਰ ਗੱਤਕਾ ਖਿਡਾਰੀ ਵੱਲੋਂ ਘੱਟ ਤੋਂ ਘੱਟ ਸੱਤ ਨੌ ਘੰਟੇ ਦੀ ਨੀਂਦ ਲੈਣੀ ਲਾਜ਼ਮੀ ਹੈ ਤਾਂ ਕਿ ਸਰੀਰ ਸਹੀ ਤਰੀਕੇ ਨਾਲ ਠੀਕ ਹੋ ਸਕੇ ਵਿਸ਼ੇਸ਼ ਤੌਰ 'ਤੇ ਗਤਕਾ ਗਤਕਾ ਦੇ ਬਾਅਦ ਯੋਗ ਅਤੇ ਮਾਸਪੇਸ਼ੀਆਂ ਦੀ ਖਿਚਤਣ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਲਚਕੀਲਾ ਬਣ ਸਕੇ ਪਾਣੀ ਦੀ ਘਾਟ ਸਰੀਰਕ ਥਕਾਵਟ ਵਧਾਅ ਸਕਦੀ ਹੈ ਪੂਰਾ ਪਾਣੀ ਪੀਣ ਵਾਲਾ ਅਤੇ ਪੋਸ਼ਟਿਕ ਭੋਜਨ ਖਾਣ ਨਾਲ ਊਰਜਾ ਬਣੀ ਰਹਿੰਦੀ ਹੈ ਖਿਡਾਰੀ ਲਈ ਸਰਸੋਂ ਦਾ ਤੇਲ ਦੀ ਮਾਲਿਸ਼ ਮਾਸਪੇਸ਼ੀਆਂ ਢਿੱਲਾ ਕਰਨ ਅਤੇ ਦਰਦ ਘਟਾਉਣ ਵਿੱਚ ਮਦਦ ਕਰਦੀ ਸਕ ਕਰਦੀ ਹੈ ਜ਼ਰੂਰੀ ਹੈ ਕਿ ਹਫਤੇ ਵਿੱਚ ਇੱਕ ਦੋ ਦਿਨਾਂ ਆਰਾਮ ਲਈਏ ਤਾਂ ਜੋ ਸਰੀਰ ਮੁੜ ਤਿਆਰ ਹੋ ਸਕੇ ਪਰਨਾ ਪ੍ਰਣਾਯਮ ਅਜਿਹਾ ਅਜਿਹੀਆਂ ਤਕਨੀਕਾ ਗਤਕਾ ਖਿਡਾਰੀ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਲਾਭਦਾਇਕ ਹੁੰਦੀਆਂ ਹਨ ਧੰਨਵਾਦ